ਅੱਜ ਪੰਜਾਬ ਦੀ ਸਿੱਖਿਆ ਪ੍ਰਣਾਲੀ ਕਾਫ਼ੀ ਵਧੀਆ ਹੋ ਚੁੱਕੀ ਹੈ ਇਸ ਵਿੱਚ ਕਈ ਪ੍ਰਕਾਰ ਦੀਆ ਸੰਸਥਾਵਾਂ ਸ਼ਾਮਿਲ ਹੋ ਚੁੱਕੀਆਂ ਹਨ ਜਿਸ ਕਰਕੇ ਅੱਜ ਦੇ ਗਰੀਬ ਬੱਚੇ ਆਪਣੀ ਸਿੱਖਿਆ ਪੂਰੀ ਕਰ ਸਕਦੇ ਆ ਜੋ ਕਿ ਜੋ ਪੇਰੈਂਟਸ ਆਪਣੇ ਬੱਚਿਆ ਨੂੰ ਨਹੀਂ ਪੜ੍ਹਾ ਸਕਦੇ ਉਹਨਾਂ ਦੇ ਲਈ ਸਰਕਾਰ ਨੇ ਕੁਝ ਸਰਕਾਰੀ ਸਕੂਲ ਖੋਲ੍ਹੇ ਹਨ ਜਿਹਨਾਂ ਦੇ ਵਿੱਚ ਉਹਨਾਂ ਨੂੰ ਰੋਟੀ ਦਿੱਤੀ ਜਾਂਦੀ ਹੈ ਜਿਸ ਨਾਲ ਉਹਨਾਂ ਦਾ ਪੋਸ਼ਟਿਕ ਅਹਾਰ ਉਹਨਾਂ ਉਹ ਉਹਨਾਂ ਨੂੰ ਮਿਲ ਜਾਂਦਾ ਹੈ ਜੋ ਕਿ ਪੇਰੈਂਟਸ ਉਹਨਾਂ ਨੂੰ ਨਹੀਂ ਦੇ ਸਕਦੇ ਹੁਣ ਸਕੂਲ ਦੇ ਵਿੱਚ ਪਹਿਲਾਂ ਹੁੰਦਾ ਸੀਗਾ ਕਿ ਬੱਚੇ ਆਪਣੀ ਮਰਜ਼ੀ ਨਾਲ ਆਉਂਦੇ ਸੀਗੇ ਕਿਉਂਕਿ ਕੁਛ ਪਹਿਲਾਂ ਸ ਸਿੱਖਿਆ ਪ੍ਰਣਾਲੀ ਇਹੋ ਜਿਹੀ ਸੀਗੀ ਕਿ ਉਸ 'ਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਜਾਂਦਾ ਸੀ ਪਰ ਅੱਜ ਸਕੂਲਾਂ ਦੇ ਵਿੱਚ ਅੱਸੀ ਪਰਸੈਂਟ ਹਾਜ਼ਰੀ ਲਾਜਮੀ ਹੈ ਜਿਸ ਕਰਕੇ ਪੇ ਬੱਚਿਆਂ ਨੂੰ ਪੇਪਰਾਂ ਦੇ ਵਿੱਚ ਬੈਠਣ ਦਿੱਤਾ ਜਾਂਦਾ ਹੈ ਇਸ ਕਰਕੇ ਬੱਚਿਆ ਦੇ ਮਨਾਂ ਵਿੱਚ ਇਹ ਡਰ ਹੁੰਦਾ ਹੈ ਕਿ ਜੇਕਰ ਅਸੀਂ ਸਕੂਲ ਨਹੀਂ ਜਾਵਾਂਗੇ ਤਾਂ ਸਾਨੂੰ ਪੇਪਰਾਂ 'ਚ ਨਹੀਂ ਬੈਠਣ ਦਿੱਤਾ ਜਾਵੇਗਾ ਇਸ ਕਰਕੇ ਪੇਰੈਂਟਸ ਵੀ ਹੁਣ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹੈ ਅਤੇ ਕੁਛ ਬੱਚੇ ਜੋ ਕਿ ਨਹੀਂ ਪੜ੍ਹ ਸਕਦੇ ਉਹਨਾਂ ਉਹਨਾਂ ਵੱਲੋਂ ਵੀ ਸ ਉਹਨਾਂ ਨੂੰ ਵੀ ਸਰਕਾਰ ਸ ਸਿੱਖਿਆ ਦਾ ਮੌਕਾ ਪ੍ਰਦਾਨ ਕਰ ਰਹੀ ਹੈ ਕੁਛ ਛੋਟੇ ਬੱਚਿਆਂ ਲਈ ਆਂਗਨਬਾੜੀ ਉਪਲਬਧ ਕੀਤੀ ਗਈ ਹੈ ਇਸ ਤਰ੍ਹਾਂ ਸ ਪੰਜਾਬ ਦੇ ਵਿੱਚ ਅਨਪੜ੍ਹ ਅ ਅਨਪੜ੍ਹਤਾ ਨੂੰ ਮੁਕਾਇਆ ਜਾ ਰਿਹਾ ਹੈ ਜਿਸ ਨਾਲ ਹੁਣ ਪੰਜਾਬ ਤਰੱਕੀਆਂ ਕਰ ਰਿਹਾ ਹੈ ਕਈ ਪ੍ਰਕਾਰ ਕਈ ਪੜ੍ਹੇ ਲਿਖੇ ਨੋਜਵਾਨ ਅੱਗੇ ਆ ਰਹੇ ਹਨ ਜਿਸ ਨਾਲ ਸਾਡਾ ਭਾਰਤ ਦੇਸ਼ ਤਰੱਕੀਆਂ 'ਤੇ ਹੈ